ਮੈਂ ਮਮਤਾ ਦੇਵੀ ਪਠਾਨਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਲੋਕ ਪੁਰਾਣੇ ਸਮੇਂ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਬੁਣਦੇ ਸਨ ਜੇਕਰ ਅਸੀਂ ਗੱਲ ਕਰੀਏ ਉਨ੍ਹਾਂ ਦੀ ਥਾਂ ਲੋਕ ਕੋਟੀਆਂ ਬੱਚਿਆਂ ਦੀਆਂ ਪਜਾਮੀਆਂ ਜੁਰਾਬਾਂ ਟੋਪੀਆਂ ਆਦਿ ਚੀਜ਼ਾਂ ਨੂੰ ਬੁਣਦੇ ਸਨ ਜੋ ਕਿ ਸਿਲਾਈਆਂ 'ਤੇ ਬੁਣਦੇ ਸੀ ਕੁਝ ਕਰੋਸ਼ੀਏ 'ਤੇ ਵੀ ਬੁਣਦੇ ਸਨ ਕੁਝ ਇਨ੍ਹਾਂ ਨੂੰ ਕੁੜੀਆਂ ਜਿਨ੍ਹਾਂ ਕੋਲ ਇਹ ਚੀਜ਼ਾਂ ਨਹੀਂ ਹੁੰਦੀਆਂ ਸੀ ਤਾਂ ਉਹ ਤੀਲੀਆਂ 'ਤੇ ਵੀ ਜਾਚ ਸਿੱਖਦੀਆਂ ਸੀ ਪਰ ਅੱਜ ਦਾ ਸਮਾਂ ਬਦਲਣ ਦੇ ਨਾਲ ਇਨ੍ਹਾਂ ਚੀਜ਼ਾਂ ਦੀ ਮਾਨਤਾ ਘੱਟਦੀ ਜਾ ਰਹੀ ਹੈ ਕਿਉਂਕਿ ਮਸ਼ੀਨੀ ਯੁੱਗ ਦੇ ਕਾਰਨ ਇਹ ਚੀਜ਼ਾਂ ਦਾ ਰਿਵਾਜ਼ ਘੱਟ ਗਿਆ ਹੈ ਜੇਕਰ ਅਸੀਂ ਗੱਲ ਕਰੀਏ ਕਿ ਪੁਰਾਣੇ ਸਮੇਂ ਵਿੱਚ ਜੁਲਾਹੀਆਂ ਅਤੇ ਖੇਸੀਆਂ ਸਾਲ ਉਨ੍ਹਾਂ ਦੇ ਕੱਪੜੇ ਆਦਿ ਦੇ ਬੁਣੇ ਜਾਂਦੇ ਸਨ ਪਰ ਅੱਜ ਇਨ੍ਹਾਂ ਦਾ ਰਿਵਾਜ਼ ਬਿਲਕੁਲ ਹੀ ਬੰਦ ਹੋ ਗਿਆ ਹੈ ਜੇਕਰ ਅਸੀਂ ਸਿਲਾਈ ਦੀ ਗੱਲ ਕਰੀਏ ਤਾਂ ਹਰ ਕਿਸਮ ਦੇ ਕੱਪੜੇ ਸਿਲਾਈ ਕੀਤੇ ਜਾ ਜਾਂਦੇ ਹਨ ਅੱਜ ਥਾਂ ਥਾਂ 'ਤੇ ਬੁਟੀਕ ਖੁੱਲ੍ਹ ਗਏ ਹਨ ਕੁਝ ਲੋਕ ਆਪਣੇ ਸ਼ੌਂਕ ਲਈ ਸਿਲਾਈ ਕਰਦੇ ਹਨ ਅਤੇ ਕੁਝ ਆਪਣੀ ਮਜਬੂਰੀ ਵਿੱਚ ਕੱਪੜੇ ਸੀਂਦੇ ਹਨ ਆਪਣੇ ਘਰ ਦਾ ਗੁਜ਼ਾਰਾ ਕਰਨ ਵਾਸਤੇ ਇਹ ਬਹੁਤ ਹੀ ਵਧੀਆ ਕੰਮ ਹੈ ਇਸਨੂੰ ਅਸੀਂ ਬੜੀਆਂ ਤਰੀਕੇ ਨਾਲ ਸਿਲਾਈ ਕਰ ਸਕਦੇ ਹਾਂ